ਮੇਰੇ ਪਿੰਡ ਦਾ ਜਿਹੜਾ ਸਰਪੰਚ ਹੈ ਸਰਦਾਰ ਪਰਵਿੰਦਰ ਸਿੰਘ ਹੈ ਜਿਹੜਾ ਕਿ ਚੰਗਾ ਵਧੀਆ ਸਰਪੰਚ ਹੈ ਉਹਨੇ ਸਾਡੇ ਪਿੰਡ ਦੀ ਬਹੁਤ ਸਾਫ ਸਫਾਈ ਕਰਾਈ ਹੈ ਬਹੁਤ ਗਰਾਂਟਾਂ ਵੀ ਅਤੇ ਪਿੰਡ ਦੀ ਜਿਹੜੀ ਆਮਦਨ ਹੈ ਉਹਦਾ 'ਚ ਵੀ ਵਾਧਾ ਕੀਤਾ ਹੈ ਅਤੇ ਗੰਦੇ ਪਾਣੀ ਦਾ ਨਿਕਾਸ ਦਾ ਬਹੁਤ ਵਧੀਆ ਪ੍ਰਬੰਧ ਕੀਤਾ ਹੈ ਜਿਹੜਾ ਸਾਡੇ ਇਲਾਕੇ ਦਾ ਐੱਮ ਐੱਲ ਏ ਹੈ ਉਹ ਇੱਕ ਨਵਾਂ ਚੁਣਿਆ ਨ ਪਹਿਲੀ ਵਾਰੀ ਬਣਿਆ ਵਿਧਾਇਕ ਹੈ ਉਹਨੂੰ ਐੱਮ ਐੱਲ ਏ ਬਣਨ ਦਾ ਕੋਈ ਬਹੁਤ ਜ਼ਿਆਦਾ ਤਜ਼ਰਬਾ ਨਹੀਂ ਹੈ ਜਿਸ ਨਾਲ ਸਰਕਾਰੀ ਸਕੀਮਾਂ ਦਾ ਕੋਈ ਬਾਹਲਾ ਲਾਭ ਨਹੀਂ ਲੈ ਸਕੇ ਅਤੇ ਸਾਡੇ ਜਿਹੜੇ ਪਿੰਡਾਂ ਦੀਆਂ ਗਰਾਂਟਾਂ ਨੇ ਉਹਦੇ ਵਿੱਚ ਵੀ ਕੋਈ ਉਹਨੇ ਬਹੁਤ ਜ਼ਿਆਦਾ ਹਿੱਸਾ ਨਹੀਂ ਪਾਇਆ ਤਾਂ ਕਿ ਉਹਨੂੰ ਆਪਣੇ ਆਪਦੇ ਐੱਮ ਐੱਲ ਏ ਹੋਣ ਦੇ ਉੱਤੇ ਜਿਹੜੀ ਉਹਦਾ ਜਿਹੜੀ ਨਿਰਭਰਤਾ ਉਹਤੇ ਜ਼ਿਆਦਾ ਉਹਨੂੰ ਆਪਣੇ ਆਪ ਦਾ ਤਜ਼ਰਬਾ ਨਹੀਂ ਹੈ ਸਰਕਾਰ ਨੂੰ ਚਾਹੀਦਾ ਕਿ ਜਿਹੜੇ ਨਵੇਂ ਐੱਮ ਐੱਲ ਏ ਬਣੇ ਨੇ ਇਹਨਾਂ ਵਾਸਤੇ ਕੋਈ ਕੈਂਪ ਲਾਏ ਜਾਣ ਸਕਣ ਤਾਂ ਕਿ ਇਹਨਾਂ ਨੂੰ ਸ਼ਕਤੀਆਂ ਦਾ ਆਪਣੇ ਅਧਿਕਾਰਾਂ ਦਾ ਪਤਾ ਲੱਗ ਸਕੇ ਜਿਹੜਾ ਸਾਡਾ ਐੱਮ ਪੀ ਹੈ ਉਹ ਇੱਕ ਰਿਟਾਇਰ ਆਈ ਪੀ ਐੱਸ ਅਫਸਰ ਹੈ ਉਹ ਵਧੀਆ ਕੰਮ ਕਰ ਰਿਹਾ ਹੈ ਅਤੇ ਉਹਨੇ ਸਾਡੇ ਜਿਹੜੇ ਇਲਾਕੇ ਦੇ ਵਿੱਚ ਵਧੀਆ ਗਰਾਂਟਾਂ ਵੰਡੀਆਂ ਹਨ ਅਤੇ ਬਿਨਾਂ ਕਿਸੇ ਭੇਦਭਾਵ ਦੇ ਵੰਡੀਆਂ ਹਨ ਜਿਹੜਾ ਲੀਡਰ ਨੇ ਕੋਈ ਵੀ ਐੱਮ ਪੀ ਐੱਮ ਐੱਲ ਏ ਹੈ ਉਹਨਾਂ ਨੂੰ ਬਿਨਾਂ ਕਿਸੇ ਪਾਰਟੀ ਤੋਂ ਉੱਪਰ ਉੱਠ ਕੇ ਸਾਰੇ ਪਿੰਡਾਂ ਦੇ ਵਿਕਾਸ ਲਈ ਇੱਕੋ ਜਿਹੀਆਂ ਗਰਾਂਟਾਂ ਦੇਣੀਆਂ ਚਾਹੀਦੀਆਂ ਹਨ